ਮੇਰਾ ਜਨਮ ਪੰਜਾਬ ਦੇ ਵਿੱਚ ਹੋਇਆ ਹੈ ਅਤੇ ਪੰਜਾਬੀ ਪੰਜਾਬ ਦੀ ਮਾਂ ਬੋਲੀ ਹੈ ਮਾਂ ਬੋਲੀ ਹਰ ਕੋਈ ਇਨਸਾਨ ਸਭ ਤੋਂ ਪਹਿਲਾਂ ਸਿੱਖਦਾ ਹੈ ਕੁਛ ਇਸ ਤਰ੍ਹਾਂ ਹੀ ਮੈਂ ਵੀ ਪੰਜਾਬੀ ਸਿੱਖਿਆ ਪੰਜਾਬੀ ਮਾਂ ਬੋਲੀ ਦੇ ਵਿੱਚ ਇੱਕ ਵੱਖਰਾ ਪ੍ਰੇਮ ਹੈ ਜੋ ਸਾਨੂੰ ਦੂਸਰੀਆਂ ਬੋਲੀਆਂ ਤੋਂ ਨਹੀਂ ਮਿਲਦਾ ਪੰਜਾਬੀ ਮਾਤ ਭਾਸ਼ਾ ਮੈਨੂੰ ਮੇਰੀ ਮਿੱਟੀ ਨਾਲ ਜੋੜ ਕੇ ਰੱਖਦੀ ਹੈ ਇਸ ਦੇ ਵਿੱਚ ਜੋ ਅਨੁਭਵ ਮੈਨੂੰ ਮਿਲਦਾ ਹੈ ਸਭ ਤੋਂ ਪਹਿਲਾਂ ਤਾਂ ਮੈਨੂੰ ਇਹ ਬੋਲੀ ਬੋਲਣ ਦੇ ਵਿੱਚ ਬੜਾ ਆਨੰਦ ਮਹਿਸੂਸ ਹੁੰਦਾ ਹੈ ਮੈਂ ਪੰਜਾਬ ਦੇ ਵਿੱਚ ਰਹਿਣ ਕਰਕੇ ਇਸ ਬੋਲੀ ਦਾ ਉਪਯੋਗ ਸਭ ਤੋਂ ਵੱਧ ਕਰਦਾ ਹਾਂ ਮੇਰੇ ਪੁਰਾਣੇ ਬਜ਼ੁਰਗ ਚਾਚੇ ਤਾਏ ਆਂਢੀ ਗੁਆਂਢੀ ਆਲੇ ਦੁਆਲੇ ਦੇ ਸਮਾਜ ਦੇ ਸਾਰੇ ਲੋਕ ਹੀ ਪੰਜਾਬੀ ਬੋਲਦੇ ਹਨ ਅਤੇ ਪੰਜਾਬੀ ਸਮਝਦੇ ਹਨ ਜਿਸ ਵਿੱਚ ਇਹ ਸਭ ਤੋਂ ਵਧੀਆ ਗੱਲਬਾਤ ਕਰਨ ਦਾ ਜ਼ਰੀਆ ਮੇਰੀ ਮਾਤ ਬੋਲੀ ਪੰਜਾਬੀ ਹੈ ਮੈਂ ਪੰਜਾਬੀ ਦੇ ਵਿੱਚ ਅਕਸਰ ਹੀ ਗੀਤ ਸੁਣਦਾ ਹਾਂ ਟੀ ਵੀ ਦੇ ਪ੍ਰੋਗਰਾਮ ਪੰਜਾਬੀ ਦੇ ਵਿੱਚ ਦੇਖਦਾ ਹਾਂ ਜੇ ਕੋਈ ਹੋਰ ਲੇਖ ਜਾਂ ਕਿਤਾਬਾਂ ਪੜ੍ਹਨੀਆਂ ਹਨ ਉਹ ਵੀ ਮੈਂ ਪੰਜਾਬੀ ਦੇ ਵਿੱਚ ਹੀ ਜ਼ਿਆਦਾਤਰ ਪੜ੍ਹਦਾ ਹਾਂ ਇਸ ਦਾ ਮੁੱਖ ਕਾਰਨ ਹੈ ਕਿ ਮੇਰਾ ਇਸ ਪੰਜਾਬੀ ਬੋਲੀ ਨਾਲ ਸਭ ਤੋਂ ਵੱਧ ਲਗਾਵ ਹੈ ਮੈਨੂੰ ਇਹ ਆਪਣੀ ਮਿੱਟੀ ਨਾਲ ਜੁੜਿਆ ਹੋਣ ਦਾ ਅਹਿਸਾਸ ਕਰਵਾਉਂਦੀ ਹੈ ਅਸੀਂ ਕਿੰਨੇ ਹੀ ਨਾਵਲਾਂ ਦੇ ਵਿੱਚ ਅਤੇ ਕਿਤਾਬਾਂ ਵਿੱਚ ਪੜ੍ਹਿਆ ਹੈ ਕਿ ਜੋ ਲੋਕ ਆਪਣੀ ਮਾਤ ਬੋਲੀ ਨੂੰ ਛੱਡ ਦਿੰਦੇ ਹਨ ਤਾਂ ਉਹ ਆਪਣੇ ਸੂਬੇ ਅਤੇ ਦੇਸ਼ ਨਾਲੋਂ ਟੁੱਟ ਜਾਂਦੇ ਹਨ ਪੰਜਾਬੀ ਬੋਲੀ ਕਈ ਦੇਸ਼ਾ ਦੇ ਵਿਚ ਬਹੁਤ ਪ੍ਰਸਿੱਧੀ ਅਤੇ ਨਾਮਨਾ ਖੱਟ ਗਈ ਹੈ ਜਿਸ ਤਰ੍ਹਾਂ ਕਨੇਡਾ ਦੇ ਵਿੱਚ ਅੱਜ ਕੱਲ੍ਹ ਪੰਜਾਬੀ ਮਾਤ ਭਾਸ਼ਾ ਦੂਸਰੇ ਨੰਬਰ ਦੀ ਭਾਸ਼ਾ ਬਣ ਗਈ ਹੈ ਸਾਨੂੰ ਪੰਜਾਬੀ ਜਾਂ ਕਿਸੇ ਵੀ ਆਪਣੀ ਮਾਂ ਬੋਲੀ ਨਾਲ ਜੁੜਨਾ ਚਾਹੀਦਾ ਹੈ ਅਤੇ ਉਸ ਨੂੰ ਸਿੱਖਣਾ ਚਾਹੀਦਾ ਹੈ